ਟੈਕਨੋਲਜੀ ਦੇ ਵਿੱਚ ਜੇ ਇੰਗਜ਼ਾਮਪਲ ਲਈਏ ਆਪਾਂ ਮੋਬਾਈਲ ਦੀ ਗੱਲ ਕਰਦੇ ਹਾਂ ਮੋਬਾਇਲ ਨੇ ਸਾਡੇ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਬਦਲਤਾ ਕਿ ਜਿਵੇਂ ਅਸੀਂ ਇੱਕ ਦੂਜੇ ਤੋਂ ਟੁੱਟੇ ਟੁੱਟੇ ਹੋ ਗਏ ਕੰਮ ਦੇ ਵਾਸਤੇ ਗੱਲ ਹੋਣੀ ਟੂ ਦਾ ਪੁਆਇੰਟ ਸਿਰਫ ਔਰ ਸਿਰਫ ਜਿੱਥੇ ਤੱਕ ਕੰਮ ਦੀ ਲੋੜ ਆ ਓਨੀ ਕੁ ਗੱਲ ਕਰਕੇ ਬੰਦਾ ਪਾਸੇ ਹੋ ਗਿਆ ਹਰ ਬੰਦਾ ਆਪਣੇ ਮੋਬਾਇਲ ਲੈ ਕੇ ਉਹਦੇ 'ਚ ਰੁਝਿਆ ਹੋਇਆ ਉਹਨੂੰ ਉਹਦੇ 'ਚੋਂ ਕੁਛ ਚਾਹੀਦਾ ਹੈ ਕਿ ਨਹੀਂ ਚਾਹੀਦਾ ਪਰ ਉਹ ਉੱਥੇ ਲੱਗਿਆ ਰਹਿੰਦਾ ਉਹਦੇ 'ਤੇ ਆਪਣਾ ਕੰਮ ਨੂੰ ਔਰ ਅਸੀਂ ਵਿੱਚ ਬੈਠਣਾ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਇਕੱਠੇ ਹੋ ਕੇ ਬਹਿਣਾ ਪਰਿਵਾਰ ਦੇ ਵਿੱਚ ਉਹ ਚੀਜ਼ਾਂ ਵੀ ਖਤਮ ਹੋ ਗਈਆਂ ਹੁਣ ਤਾਂ ਰੋਟੀ ਖਾਂਦੇ ਪਏ ਹਾਂ ਬੱਚੇ ਤਾਂ ਉਹ ਮੋਬਾਈਲ ਸਾਹਮਣੇ ਰੱਖ ਕੇ ਬੈਠੇ ਲੱਗੇ ਮੋਬਾਇਲ ਦੇਖਣ ਲੱਗੇ ਹੋਏ ਆ ਉਹ ਮਾਂ ਬਾਪ ਨਾਲ ਗੱਲ ਨਹੀਂ ਕਰ ਰਹੇ ਮਾਂ ਬਾਪ ਉਹਨਾਂ ਨਾਲ ਗੱਲ ਨਹੀਂ ਕਰ ਰਹੇ ਮਾਂ ਬਾਪ ਨੂੰ ਇਹ ਹੈ ਕਿ ਉਹ ਰੋਟੀ ਖਾ ਲਵੇ ਮੋਬਾਈਲ ਉਹਨੂੰ ਦਿੱਤਾ ਹੋਇਆ ਇਹਨਾਂ ਚੀਜ਼ਾਂ ਨੇ ਨਾ ਬਹੁਤ ਜ਼ਿਆਦਾ ਜਿੰਦਗੀ ਅਜੀਬ ਜਿਹੀ ਕਰਤੀ ਬਦਲ ਜਿਹੀ ਦਿੱਤੀ ਬੱਚੇ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਯਾਰ ਦੋਸਤਾਂ ਨਾਲ ਰੁੱਝੇ ਰਹਿੰਦੇ ਆ ਉਹ ਆਪਣੇ ਮਾਂ ਬਾਪ ਨਾਲ ਉੱਨਾ ਜ਼ਿਆਦਾ ਇੰਟਰੈਕਟ ਹੁੰਦੇ ਹੀ ਨਹੀਂ ਤਾਂ ਕਈ ਪਰਿਵਾਰ ਐਸੇ ਹੋ ਗਏ ਜਿਨ੍ਹਾਂ ਦੇ ਵਿੱਚ ਹਸਬੈਂਡ ਅਤੇ ਵਾਈਫ਼ ਦੋਨੋਂ ਵਰਕਿੰਗ ਹੈ ਮਾਤਾ ਪਿਤਾ ਜਾਣੀ ਕਿ ਤਾਂ ਉੱਥੇ ਉਹਨਾਂ ਦੇ ਕੋਲ ਉੱਨਾ ਟਾਇਮ ਹੀ ਨਹੀਂ ਬਚਦਾ ਬੱਚਿਆਂ ਦੇ ਕੋਲ ਉੱਠਣ ਬੈਠਣ ਦਾ ਉਹ ਆਪਣੇ ਕੰਮਾਂ 'ਤੇ ਲੱਗੇ ਰਹਿ ਜਾਂਦੇ ਆ ਇਹ ਚੀਜ਼ਾਂ ਬੜੀਆਂ ਗਲਤ ਜਿਹੀਆਂ ਹੁੰਦੀਆਂ ਜਾ ਰਹੀਆਂ ਪਰਿਵਾਰ ਟੁੱਟ ਰਹੇ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਦੂਰੀਆਂ ਵੱਧ ਰਹੀਆਂ ਇੱਕ ਦੂਜੇ ਦੇ ਵੀ ਨਾਲ ਬੈਠਣਾ ਗੱਲਬਾਤ ਕਰਨਾ ਹਮਦਰਦੀ ਜਤਾਉਣਾ ਕੋਈ ਚੀਜ਼ ਹੈ ਕੋਈ ਗੱਲ ਹੈ ਉਹਨੂੰ ਸੁਲਝਾਉਣਾ ਗੱਲਬਾਤ ਕਰਨੀ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ